ਤੁਸੀਂ ਵੱਖਰੇ ਸ਼ਹਿਰ ਵਿੱਚ ਜਾ ਕੇ ਜਾ ਰਹੇ ਹੋ ਜਿੱਥੇ ਇੱਕ ਵੱਖਰਾ ਗੈਸ ਸਲੰਡਰ ਪਹੁੰਚ ਦੇ ਯੋਗ ਹੋਵੇ ਇਸ ਲਈ ਤੁਹਾਨੂੰ ਆਪਣੀ ਮੌਜੂਦਾ ਬੁਕਿੰਗ ਰੱਦ ਕਰਨ ਦੀ ਜ਼ਰੂਰਤ ਹੈ ਮੈਂ ਆਪਣੇ ਅਡਰੈਸ ਚੇਂਜ ਕਰਨ ਦੇ ਨਾਲ ਮੈਂ ਆਪਣੇ ਸਿਲਿੰਡਰ ਦੀ ਐਡਰੈਸ ਬੁਕਿੰਗ ਚੇਂਜ ਕਰਵਾਉਣੀ ਹਨ ਜਿਸ ਕਰਕੇ ਮੈਂ ਆਪਣੇ ਨਾਲ ਦੇ ਦੋਸਤਾਂ ਤੋਂ ਪੁੱਛਿਆ ਕਿ ਐਡਰੈਸ ਕਿੱਛੇ ਚੇਂਜ ਹੁੰਦਾ ਹੈ ਅਤੇ ਮੈਂ ਐਡਰੈਸ ਚੇਂਜ ਬਾਰੇ ਪੁੱਛ ਕੇ ਉਹਨਾਂ ਕੋਲੋਂ ਉੱਥੇ ਏਜੰਸੀ ਦੇ ਵਿੱਚ ਗਿਆ ਅਤੇ ਉਹਨਾਂ ਨੂੰ ਮੈਂ ਆਪਣੇ ਕਈ ਪ੍ਰੂਫ ਦਿੱਤੇ ਨਵੇਂ ਘਰ ਦੇ ਜਿੱਥੇ ਮੈਂ ਨਵੇਂ ਸ਼ਿਫਟ ਹੋਇਆ ਹਾਂ ਉੱਥੇ ਦੇ ਪਰੂਫ ਦਿੱਤੇ ਅਤੇ ਉਹਨਾਂ ਨੇ ਸਾਰਾ ਕੁਛ ਅਪਡੇਟ ਕਰਕੇ ਮੈਨੂੰ ਪ੍ਰੂਫ ਵਾਪਸ ਕਰ ਦਿੱਤੇ ਅਤੇ ਉਹਨਾਂ ਨੇ ਕੁਝ ਕੁ ਸਮੇਂ ਦਾ ਮੈਨੂੰ ਟਾਈਮ ਦਿੱਤਾ ਅਤੇ ਕਹਿੰਦੇ ਅਪਡੇਟ ਹੋ ਕੇ ਤੁਹਾਡੇ ਘਰ ਆ ਆ ਜਾਵੇਗਾ ਅਤੇ ਤੁਹਾਨੂੰ ਸਿਲੰਡਰ ਘਰ ਪਹੁੰਚਦਾ ਹੋ ਜਾਇਆ ਕਰੇਗਾ ਅਤੇ ਆਨਲਾਈਨ ਫੋਨ ਤੋਂ ਬੁੱਕ ਹੋ ਜਾਇਆ ਕਰੇਗਾ ਅਤੇ ਦੋ ਅਠਤਾਲੀ ਘੰਟੇ ਦੇ ਵਿੱਚ ਵਿੱਚ ਸਲੰਡਰ ਤੁਹਾਡੇ ਕੋਲ ਘਰ ਪਹੁੰਚਦਾ ਹੋ ਜਾਏਗਾ